ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਇੱਕ ਨਵੰਬਰ ਉੱਨੀ ਸੌ ਸੱਤਰ ਦਸ ਦਸੰਬਰ ਦੋ ਹਜ਼ਾਰ ਵੀਹ ਅਕਤੂਬਰ ਦੋ ਹਜ਼ਾਰ ਬਾਰ੍ਹਾਂ